ਚਿੱਤਰਕਾਰੀ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਦੇਖਣ ਵਿੱਚ ਤਾਂ ਇੰਨੀ ਸੋਹਣੀ ਲੱਗਦੀ ਹੈ ਪਰ ਜਦ ਕਰਨ ਬੈਠੀਏ ਤਾਂ ਉੰਨੀ ਹੀ ਔਖੀ ਮੇਰੇ ਲਈ ਚਿੱਤਰਕਾਰੀ ਦਾ ਸਭ ਤੋਂ ਔਖਾ ਅਤੇ ਚਣੌਤੀਪੂਰਨ ਪਹਿਲੂ ਹੈ ਖ਼ਾਸ ਤੌਰ ਉਤੇ ਅਗਰ ਅਸੀਂ ਕਿਸੇ ਬਚਿੰਦਾ ਚੀਜ਼ ਦਾ ਚਿੱਤਰ ਬਣਾ ਰਹੇ ਹਾਂ ਤਾਂ ਉਹਨਾਂ ਦੀਆਂ ਅੱਖਾਂ ਨੈਣ ਨਕਸ਼ ਨੱਕ ਮੂੰਹ ਅਤੇ ਸਭ ਤੋਂ ਔਖਾ ਉਹਨਾਂ ਦੇ ਹੱਥ ਪੈਰ ਅਤੇ ਹੋਰ ਮੈਂ ਇਸ ਨੂੰ ਦੂਰ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਅਭਿਆਸ ਕਰਦੀ ਹਾਂ ਅਤੇ ਦੂਸਰਾ ਚੀਜ਼ ਸਭ ਤੋਂ ਜ਼ਰੂਰੀ ਇਹਨਾਂ ਸਭ ਚੀਜ਼ਾਂ ਨੂੰ ਅਗਰ ਗੌਰ ਨਾਲ ਦੇਖਣਾ ਅਤੇ ਸਮਝ ਕੇ ਹੀ ਉਹਨਾਂ ਦਾ ਪ੍ਰਦਰਸ਼ਨ ਕਰਨਾ ਇਸ ਤੋਂ ਇਲਾਵਾ ਅਗਰ ਕੁਛ ਬਣਾਉਣਾ ਔਖਾ ਹੁੰਦਾ ਹੈ ਉਹ ਹੈ ਥਰੀ ਡੀ ਡਰਾਈਗ ਕਿਉਂਕਿ ਉਹ ਅਜਿਹੀ ਪ੍ਰਕਾਰ ਦੀ ਚਿੱਤਰਕਾਰੀ ਹੁੰਦੀ ਹੈ ਜਿਸਨੂੰ ਜਦੋਂ ਦੇਖੀਏ ਤਾਂ ਅਜਿਹਾ ਲੱਗੇ ਕਿ ਸਾਡੇ ਸਾਹਮਣੇ ਹੀ ਹੈ ਇਸਦਾ ਅਭਿਆਸ ਤਾਂ ਬਾਰ ਬਾਰ ਉਹਨੂੰ ਬਣਾ ਕੇ ਹੀ ਹੁੰਦਾ ਹੈ ਅਤੇ ਖ਼ਾਸ ਤੌਰ ਉੱਤੇ ਜਦ ਅਸੀਂ ਕੋਈ ਚਿੱਤਰਕਾਰੀ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਉਹਨੂੰ ਹਮੇਸ਼ਾਂ ਪੈਨਸਿਲ ਨਾਲ ਹੀ ਕਰਨਾ ਚਾਹੀਦਾ ਹੈ ਫਿਰ ਉਹਦੇ ਉੱਤੇ ਤੁਸੀਂ ਜਿਵੇਂ ਮਰਜ਼ੀ ਉਹਨੂੰ ਰੰਗ ਰੋਗਣ ਕਰ ਸਕਦੇ ਹੋ ਅਤੇ ਉਹਨੂੰ ਸੋਹਣਾ ਬਣਾ ਸਕਦੇ ਹੋ